ਨਵੇਂ ਜਨਮੇ ਬੱਚਿਆਂ ਦੀ ਦੇਖਭਾਲ ਬਹੁਤ ਹੀ ਜ਼ਰੂਰੀ ਹੈ ਅੱਜ ਦੇ ਬਦਲਦੇ ਮੌਸਮ ਅਤੇ ਵਾਤਾਵਰਣ ਸਥਿਤੀਆਂ ਨੂੰ ਦੇਖਦੇ ਹੋਏ ਬੱਚਿਆਂ ਲਈ ਸਭ ਤੋਂ ਜ਼ਰੂਰੀ ਹੈ ਕਿ ਜਿੰਨਾਂ ਹੋ ਸਕੇ ਉਹਨਾਂ ਨੂੰ ਘਰ ਦੇ ਅੰਦਰ ਹੀ ਰੱਖਿਆ ਜਾਵੇ ਅਤੇ ਪ੍ਰਦੂਸ਼ਣ ਦੇ ਸਿਖਰਲੇ ਘੰਟਿਆਂ ਦੌਰਾਨ ਆਮ ਤੌਰ 'ਤੇ ਸਵੇਰੇ ਜਲਦੀ ਅਤੇ ਦੇਰ ਸ਼ਾਮ ਨੂੰ ਹੀ ਬਾਹਰ ਜਾਇਆ ਜਾਵੇ ਕਿਉਂਕਿ ਇਸ ਸਮੇਂ ਵਾਹਨ ਘੱਟ ਹੁੰਦੇ ਹਨ ਅਤੇ ਹਵਾ ਸ਼ੁੱਧ ਹੁੰਦੀ ਹੈ ਹਵਾ ਸ਼ੁੱਧ ਕਰਨ ਵਾਲੇ ਯੰਤਰਾ ਦੀ ਵੀ ਘਰ ਵਰਤੋਂ ਕੀਤੀ ਜਾ ਸਕਦੀ ਹੈ ਜਿਵੇਂ ਕਿ ਐਚ ਈ ਪੀ ਏ ਫਿਲਟਰ ਵਾਲੇ ਉੱਚ ਗੁਣਵੱਤਾ ਏਅਰ ਪਯੁਰੀਫਾਈ ਜੋ ਕਿ ਸਾਫ਼ ਹਵਾ ਬਣਾਈ ਰੱਖਦੇ ਹਨ ਅਜਿਹੀਆਂ ਗਤੀਵਿਧੀਆਂ ਤੋਂ ਬਚਣਾ ਚਾਹੀਦਾ ਹੈ ਜੋ ਕਿ ਘਰ ਦੇ ਅੰਦਰ ਪ੍ਰਦੂਸ਼ਣ ਵਧਾਉਂਦੀਆਂ ਜਿਵੇਂ ਕੀ ਧੂਫ ਅਤੇ ਮੋਮਬੱਤੀਆਂ ਜਲਾਉਣਾ ਖ਼ਾਸ ਤੌਰ 'ਤੇ ਬੱਚਿਆਂ ਦੇ ਕੋਲ ਇਸ ਚੀਜ਼ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਧੂੜ ਘਟਾਉਣ ਲਈ ਫਿਲਟਰ ਕੀਤੇ ਵੈਕਿਊਮ ਨਾਲ ਅਤੇ ਫਰਸ਼ਾਂ ਨੂੰ ਵਾਰ ਵਾਰ ਸਾਫ਼ ਕਰਨਾ ਜ਼ਰੂਰੀ ਬਣਾਇਆ ਜਾਣਾ ਚਾਹੀਦਾ ਹੈ ਸਹੀ ਹਵਾਦਾਰੀ ਵੀ ਘਰ ਵਿੱਚ ਹੋਣੀ ਜ਼ਰੂਰੀ ਹੈ ਨਾ ਕਿ ਕਮਰੇ ਨੂੰ ਜਮ੍ਹਾਂ ਹੀ ਬੰਦ ਕਰਕੇ ਅਤੇ ਬੱਚੇ ਨੂੰ ਅੰਦਰ ਹੀ ਰੱਖ ਲਿਆ ਜਾਵੇ ਬਾਹਰ ਨਿਕਲਦੇ ਸਮੇਂ ਵੱਡੇ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਪ੍ਰਦੂਸ਼ਣ ਰੋਕੂ ਮਾਸਕ ਦੀ ਵਰਤੋਂ ਕਰ ਲੈਣੀ ਜ਼ਰੂਰੀ ਹੈ ਪਰ ਛੋਟੇ ਬੱਚਿਆਂ ਲਈ ਮਾਸਕ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਇਸ ਲਈ ਕੋਈ ਜਾਲੀਦਾਰ ਕੱਪੜਾ ਜਾਂ ਚੁੰਨੀ ਦੀ ਵਰਤੋਂ ਕਰਕੇ ਉਹਨਾਂ ਦਾ ਮੂੰਹ ਢੱਕਿਆ ਜਾ ਸਕਦਾ ਹੈ ਪਰੰਤੂ ਜ਼ਿਆਦਾ ਸਮੇਂ ਲਈ ਨਹੀਂ ਸਭ ਤੋਂ ਜ਼ਰੂਰੀ ਹੈ ਖਾਣ ਪਾਣ ਨਵਜਨਮੇ ਬੱਚੇ ਲਈ ਜੇਕਰ ਖਾਣ ਪੀਣ ਦੇ ਚੀਜ਼ਾਂ ਵੱਲ ਵੱਧ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ ਡਾਕਟਰ ਦੀ ਸਮੇਂ ਸਿਰ ਸਲਾਹ ਲੈਂਦੇ ਰਹਿਣਾ ਵੀ ਸਭ ਤੋਂ ਜ਼ਰੂਰੀ ਹੈ ਜੇਕਰ ਪਲੂਸ਼ਣ ਦਾ ਪੱਧਰ ਲੰਬੇ ਸਮੇਂ ਤੱਕ ਖ਼ਰਾਬ ਰਹਿੰਦਾ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰੀ ਹੈ